ਸਾਡੇ ਸਰਕਾਰ ਵੱਲੋਂ ਬਹੁਤ ਸਾਰੇ ਉਪਰਾਲੇ ਕੀਤੇ ਗਏ ਜਿਵੇਂ ਕਿ ਹੁਣ ਮੁਹੱਲਾ ਕਲੀਨਿਕ ਉਹਨਾਂ ਦਾ ਵੀ ਉਦਘਾਟਨ ਕੀਤਾ ਗਿਆ ਤਾਂ ਕਿ ਜੋ ਜਿਹੜੇ ਨੇੜੇ ਦੇ ਲੋਕ ਹੈ ਜਿਹੜੇ ਬਿਮਾਰ ਨੇ ਉਹ ਈਜ਼ਿਲੀ ਆ ਕੇ ਉੱਥੇ ਆਪਣੇ ਡੋਕਟਰ ਨਾਲ ਸਲਾਹ ਲੈ ਕੇ ਉੱਥੇ ਬਿਮਾਰੀ ਦਾ ਆਪਣਾ ਇਲਾਜ ਕਰਵਾ ਸਕਣ ਅਤੇ ਨਾਲ ਦੀ ਨਾਲ ਲੋਕਾਂ ਨੂੰ ਜਿੱਦਾਂ ਪੋਪੂਲੇਸ਼ਨ ਜਿਹੜੀ ਹਾਈ ਹੋ ਰਹੀ ਹੈ ਉਹਦੇ ਲਈ ਵੀ ਫੈਮਿਲੀ ਪਲੈਨਿੰਗ ਦਾ ਉਹਨਾਂ ਨੂੰ ਐਡਵਾਈਜ਼ ਕੀਤਾ ਜਾਂਦਾ ਉਹਨਾਂ ਨੂੰ ਐਜੂਕੇਟ ਕੀਤਾ ਜਾਂਦਾ ਤਾਂ ਕਿ ਉਹ ਜਿਹੜੀ ਆਪਣੀ ਇਸ ਐਜੂਕੇਸ਼ਨ ਨੂੰ ਅੱਗੇ ਵਧਾ ਕੇ ਸਰਕਾਰ ਦੇ ਨਾਲ ਆਪਣੇ ਇਕਜੁੱਟ ਹੋ ਕੇ ਅੱਗੇ ਤੋਂ ਅੱਗੇ ਬਿਮਾਰੀਆਂ ਨੂੰ ਵੀ ਘੱਟ ਕੀਤਾ ਜਾਵੇ ਅਤੇ ਬੇਰੁਜ਼ਗਾਰੀ ਨੂੰ ਵੀ ਘੱਟ ਕੀਤਾ ਜਾਵੇ ਤੁਹਾਡਾ ਡਾਕਟਰ ਦੀ ਸਲਾਹ ਨਾਲ ਇਸ ਬਿਮਾਰੀਆਂ ਨੂੰ ਦੂਰ ਕੀਤਾ ਜਾ ਰਿਹਾ